ਪੰਜ ਜਨਵਰੀ ਦੋ ਹਜ਼ਾਰ ਪੰਦਰਾਂ ਗਿਆਰਾਂ ਫੈਬਰੇਰੀ ਦੋ ਹਜ਼ਾਰ ਸੋਲਾਂ ਉੱਨੀ ਮਾਰਚ ਦੋ ਹਜ਼ਾਰ ਅਠਾਰਾਂ ਵੀਹ ਅਪ੍ਰੈਲ ਦੋ ਹਜ਼ਾਰ ਵੀਹ ਤੇਰਾਂ ਅਗਸਤ ਦੋ ਹਜ਼ਾਰ ਇੱਕੀ